ਸਥਾਨਕ ਆਰਥਕਤਾ ਵਿੱਚ ਜਿਹੜਾ ਹਰ ਇੱਕ ਭਾਸ਼ਾ ਦਾ ਬਹੁਤ ਮਹੱਤਵ ਹੁੰਦਾ ਕਿਉਂਕਿ ਜੇਕਰ ਆਮ ਗੱਲ ਕਰੀਏ ਕਿ ਵਪਾਰੀ ਨੂੰ ਜਿੱਥੇ ਉਸਨੇ ਜਾਣਾ ਵਪਾਰ ਕਰਨਾ ਉੱਥੋਂ ਦੀ ਭਾਸ਼ਾ ਆਊਗੀ ਤਾਂ ਹੀ ਉਹ ਇੱਕ ਚੰਗਾ ਵਪਾਰੀ ਹੋ ਸਕਦਾ ਹੈ ਕਿਉਂਕਿ ਜੇਕਰ ਭਾਸ਼ਾ ਨਾ ਆਊਗੀ ਤਾਂ ਉੱਥੋਂ ਦੇ ਵਸ਼ਿੰਦੇ ਲੋਕ ਉਸਨੂੰ ਸਮਝ ਨਹੀਂ ਸਕਣਗੇ ਉਦਾਹਰਣ ਵਜੋਂ ਅੰਗਰੇਜ਼ਾਂ ਨੂੰ ਭਾਰਤ ਵਿੱਚ ਵਪਾਰ ਕਰਨ ਲਈ ਪੰਜਾਬੀ ਸਿੱਖਣੀ ਪਈ ਜਾਂ ਮੰਨ ਲਓ ਪੰਜਾਬ ਦੇ ਵਿੱਚ ਵਪਾਰ ਕਰਨ ਲਈ ਪੰਜਾਬੀ ਸਿੱਖਣੀ ਪਈ ਕਿਉਂਕਿ ਪੰਜਾਬ ਦੇ ਲੋਕ ਸਿਰਫ਼ ਪੰਜਾਬੀ ਜਾਣਦੇ ਸੀ ਇਸ ਦੇ ਨਾਲ ਹੀ ਜਿਵੇਂ ਆਪਾਂ ਹੁਣ ਗੱਲ ਕਰੀਏ ਵਪਾਰੀਆਂ ਦੀ ਜਦੋਂ ਵਪਾਰੀ ਦਾ ਕਿਸਾਨ ਜਾਂ ਮਜ਼ਦੂਰ ਨਾਲ ਰਾਬਤਾ ਹੋਊਗਾ ਕਹਿ ਲਓ ਗੱਲਬਾਤ ਹੋਵੇਗੀ ਤਾਂ ਫਿਰ ਉਹ ਪੰਜਾਬੀ ਵਿੱਚ ਹੀ ਕਰਨੀ ਪਵੇਗੀ ਕਿਉਂਕਿ ਪੰਜਾਬੀ ਹੀ ਵਪਾਰੀ ਨੂੰ ਆਉਂਦੀ ਹੈ ਵਪਾਰੀ ਨੂੰ ਪੰਜਾਬੀ ਆਊਗੀ ਤਾਂ ਹੀ ਉਹ ਮਜ਼ਦੂਰ ਤੋਂ ਜਾਂ ਕਿਸਾਨ ਤੋਂ ਕੰਮ ਲੈ ਸਕਦਾ ਜਾਂ ਫ਼ਸਲ ਖ਼ਰੀਦ ਵੇਚ ਸਕਦਾ ਹੈ ਉਹ ਉਸ ਤੋਂ ਨਵੀਂ ਫਸਲ ਉਗਵਾ ਵੀ ਸਕਦਾ ਕਿ ਉਸਨੂੰ ਕੀ ਲੋੜ ਹੈ ਜਿਹੜੀ ਚੀਜ਼ ਦੀ ਲੋੜ ਹੈ ਉਹ ਉਹ ਤੋਂ ਉਗਵਾਉਗਾ ਇਸ ਦੇ ਨਾਲ ਹੀ ਉਹ ਆਮ ਪੰਜਾਬੀ ਦੇ ਸ਼ਬਦਾਂ ਵਿੱਚ ਵਰਤ ਕੇ ਉਸਦੇ ਨਾਲ ਆਪਣਾ ਪਣ ਵੀ ਪੇਸ਼ ਜਿਹੜਾ ਉਹ ਜਤਾਵੇਗਾ